ਸਾਡੇ ਇਸ ਖੇਤਰ ਵਿੱਚ ਬਹੁਤ ਸਾਰੇ ਵੈਟਨਰੀ ਡਾਕਟਰ ਹਨ ਜਿਹਨਾਂ ਦੇ ਵਿੱਚ ਕੁਝ ਪ੍ਰਾਈਵੇਟ ਵੀ ਹਨ ਅਤੇ ਕੁਝ ਸਰਕਾਰੀ ਵੀ ਹਨ ਸਾਡੇ ਇਲਾਕੇ ਦੇ ਵਿੱਚ ਸਰਕਾਰੀ ਸਹੂਲਤਾਂ ਵਿੱਚ ਵੈਟਨਰੀ ਡਾਕਟਰ ਕਾਫੀ ਉਪਲਬਧ ਹਨ ਜਿਹਨਾਂ ਕੋਲ ਅਸੀਂ ਟਾਈਮ ਟੂ ਟਾਈਮ ਜਾ ਕੇ ਆਪਣੇ ਪਾਲਤੂ ਪਾਲਤੂ ਪਸ਼ੂ ਦੀ ਜਾਂਚ ਕਰਵਾ ਸਕਦੇ ਹਾਂ ਜਿਹਨਾਂ ਦੇ ਵਿੱਚ ਉਹਨਾਂ ਨੂੰ ਆਪਾਂ ਤਿੰਨ ਤਰ੍ਹਾਂ ਨਾਲ ਸੁਰਕਸ਼ਿਤ ਰੱਖ ਸਕਦੇ ਹਾਂ ਜਿਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਜਾਨਵਰਾਂ ਦੀ ਸਾਫ ਸਫਾਈ ਅਸੀਂ ਜਾਨਵਰਾਂ ਦੀ ਸਾਫ ਸਫਾਈ ਦਾ ਪੂਰਾ ਧਿਆਨ ਰੱਖ ਰੱਖਾਂਗੇ ਤਾਂ ਹੀ ਉਹ ਬਿਲਕੁਲ ਤੰਦਰੁਸਤ ਰਹਿਣਗੇ ਜਿੱਥੇ ਉਹ ਰਹਿੰਦੇ ਹਨ ਜਾਂ ਸੌਂਦੇ ਹਨ ਉਸ ਜਗ੍ਹਾ ਨੂੰ ਵੀ ਬਿਲਕੁਲ ਸਾਫ ਸੁਥਰਾ ਰੱਖਾਂਗੇ ਅਤੇ ਜਾਨਵਰਾਂ ਨੂੰ ਵੀ ਟਾਈਮ ਦੇ ਨਾਲ ਨਵਾਉਂਦੇ ਰਵਾਂਗੇ ਤਾਂ ਜੋ ਉਹ ਬਿਲਕੁਲ ਠੀ ਤੰਦਰੁਸਤ ਰਹਿਣ ਅਤੇ ਉਹਨਾਂ ਤੋਂ ਕਿਸੇ ਨੂੰ ਕੋਈ ਕੀਟਾਣੂ ਵੀ ਨਾ ਜਾਵੇ ਦੂਸਰਾ ਉਹਦੇ ਵਿਚ ਆਪਾਂ ਉਹਨਾਂ ਦਾ ਟਾਈਮ ਤੋਂ ਟਾਈਮ ਟੀਕਾਕਰਨ ਕਰਵਾ ਸਕ ਕਰਵਾ ਕੇ ਵੀ ਅਸੀਂ ਉਹਨਾਂ ਨੂੰ ਸੁਰਕਸ਼ਿਤ ਰੱਖ ਸਕਦੇ ਹਾਂ ਜਿਹਨਾਂ ਦੇ ਵਿੱਚ ਰੇਬੀਸ ਦਾ ਟੀਕਾ ਵੀ ਆਉਂਦਾ ਹੈ ਜਿਸ ਨਾਲ ਕੁੱਤਿਆਂ ਤੋਂ ਕਿਸੇ ਵੀ ਆਦਮੀ ਨੂੰ ਕੋਈ ਖਤਰਾ ਨਹੀਂ ਹੋ ਸਕਦਾ ਅਗਰ ਉਹ ਉਸਨੂੰ ਕੱਟ ਵੀ ਦਿੰਦਾ ਹੈ ਤਾਂ ਜੋ ਉਹ ਬਿਲਕੁਲ ਠੀਕ ਰਹਿਣ ਤੀਸਰਾ ਇਸ ਦੇ ਵਿੱਚ ਆਉਂਦਾ ਹੈ ਕਿ ਆਪਾਂ ਟਾਈਮ ਟੂ ਟਾਈਮ ਆਪਣੇ ਪਸ਼ੂਆਂ ਨੂੰ ਡਾਕਟਰਾਂ ਨੂੰ ਦਿਖਾਉਂਦੇ ਰਹੀਏ ਤਾਂ ਜੋ ਉਹਨਾਂ ਦਾ ਸਮੇਂ ਸਿਰ ਇਲਾਜ ਹੋ ਸਕੇ ਤਾਂ ਜੋ ਉਹਨਾਂ ਨੂੰ ਖਾਣ ਪੀਣ ਦੇ ਵਿੱਚ ਵੀ ਬਿਲਕੁਲ ਸਹੀ ਚੀਜ਼ਾਂ ਦਿੱਤੀਆਂ ਜਾਣ